ਸਮੇਂ ਦੇ ਨਾਲ਼ ਨਾਲ਼ ਤੁਸੀਂ ਦੇਖਿਆ ਕਿ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਬਦਲਾਵ ਦੇਖੇ ਗਏ ਹਨ ਜਿਵੇਂ ਕਿ ਪੰਜਾਬ ਵਿੱਚ ਬਹੁਤ ਸਾਰੇ ਕੋਨਵੈਂਟ ਸਕੂਲ ਖੁੱਲ੍ਹ ਗਏ ਹਨ ਜਿਨ੍ਹਾਂ ਵਿੱਚ ਬੱਚਿਆਂ ਨੂੰ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਨਹੀਂ ਪੜ੍ਹਾਈ ਜਾਂਦੀ ਉਹਨਾਂ ਨੂੰ ਪੰਜਾਬੀ ਕੋਨਵੈਂਟ ਸਕੂਲ ਵਿੱਚ ਤਾਂ ਪੰਜਾਬੀ ਬਿਲਕੁਲ ਹੀ ਖ਼ਤਮ ਹੀ ਕਰ ਦਿੱਤੀ ਗਈ ਹੈ ਉੱਥੇ ਸਾਰੇ ਟੀਚਰਸ ਵੀ ਹੈ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਯਾ ਤਾਂ ਉਹ ਇੰਗਲਿਸ਼ ਬੱਚਿਆਂ ਨਾਲ਼ ਇੰਗਲਿਸ਼ ਦੇ ਵਿੱਚ ਗੱਲਬਾਤ ਕਰਦੇ ਹੈ ਯਾ ਉਹ ਪੰਜਾਬੀ ਦੇ ਵਿੱਚ ਗੱਲਬਾਤ ਕਰਦੇ ਹੈ ਬੱਚਿਆਂ ਨੂੰ ਉਹ ਕਹਿੰਦੇ ਹੈ ਕਿ ਤੁਸੀਂ ਘਰਾਂ ਵੀ ਜਿਹੜੀ ਬੱਚਿਆਂ ਦੇ ਨਾਲ਼ ਇੰਗਲਿਸ਼ ਦੇ ਵਿੱਚ ਗੱਲ ਉਹਨਾਂ ਨੂੰ ਆਪਣੀ ਮਾਂ ਬੋਲੀ ਨਾਲ਼ ਤੋੜਿਆ ਜਾ ਰਿਹਾ ਏ ਪੰਜਾਬੀ ਜਦੋਂ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਪੰਜਾਬੀ ਬੋਲਣੀ ਆਉਣੀ ਬਹੁਤ ਜ਼ਰੂਰੀ ਹੈ ਅਸੀਂ ਇੱਕ ਮਤਲਬ ਕਿ ਇੱਕ ਉਹਦੇ ਵਿੱਚ ਪਿਸ ਰਹੇ ਹਾਂ ਕਿ ਨਾ ਤਾਂ ਅਸੀਂ ਪੰਜਾਬੀ ਚੰਗੀ ਤਰ੍ਹਾਂ ਸਿੱਖ ਰਹੇ ਹਾਂ ਅਤੇ ਨਾ ਹੀ ਅਸੀਂ ਇੰਗਲਿਸ਼ ਚੰਗੀ ਤਰ੍ਹਾਂ ਸਿੱਖ ਰਹੇ ਹਾਂ ਅਸੀਂ ਦੋਨਾਂ ਭਾਸ਼ਾਵਾਂ ਦੇ ਵਿੱਚ ਮਾਰ ਖਾ ਰਹੇ ਹਾਂ ਕਿਉਂ ਕਿਉਂਕਿ ਅਸੀਂ ਰਹਿੰਦੇ ਪੰਜਾਬ ਪੰਜਾਬ ਦੇਸ਼ ਵਿੱਚ ਹਾਂ ਬਟ ਅਸੀਂ ਸਿੱਖਣਾ ਕੀ ਚਾਹੁੰਦੇ ਹਾਂ ਇੰਗਲਿਸ਼ ਚਾਹੁੰਦੇ ਹਾਂ ਅਸੀਂ ਘਰਾਂ ਕੀ ਬੋਲਦੇ ਹਾਂ ਪੰਜਾਬੀ ਬੋਲਦੇ ਹਾਂ ਅਤੇ ਸਕੂਲ ਸਾਨੂੰ ਟੀਚਰਸ ਕਿਸ ਉਹਦੇ ਨਾਲ਼ ਗੱਲ ਕਰਦੇ ਹਾਂ ਇੰਗਲਿਸ਼ ਦੇ ਵਿੱਚ ਗੱਲ ਕਰਦੇ ਆ ਪਰ ਸਾਨੂੰ ਸਭ ਤੋਂ ਜ਼ਿਆਦਾ ਇਫੈਕਟ ਪੈਂਦਾ ਹੈ ਕਿ ਸਾਡੇ ਘਰ ਦੇ ਵਿੱਚ ਕਿਹੜੀ ਭਾਸ਼ਾ ਵਰਤੀ ਜਾਂਦੀ ਹੈ ਇਸ ਕਰਕੇ ਜਿਹੜੀ ਹੈ ਸਕੂਲਾਂ ਦੇ ਵਿੱਚ ਜਿਹੜੀ ਹੈ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣੀ ਜਾਂ ਪੜ੍ਹਾਉਣੀ ਚਾਹੀਦੀ ਹੈ